ਹੈਲੋ ਹਾਂਜੀ ਮੈਂ ਡਾਕਟਰ ਨੀਸ਼ਾ ਸ਼ਰਮਾ ਗੱਲ ਕਰ ਰਹੀ ਹਾਂ ਸਿਵਿਲ ਹੋਸਪੀਟਲ ਤੋਂ ਹਾਂਜੀ ਬੋਲੋ ਤੁਸੀਂ ਕੌਣ ਹਾਂਜੀ ਬੋਲੋ ਹਾਂ ਮਤਲਬ ਆ ਤਾਂ ਸਕਾਂਗੀ ਤੁਸੀਂ ਮੈਨੂੰ ਐਂ ਦੱਸੋ ਮਤਲਬ ਪ੍ਰੋਬਲਮ ਕੀ ਹੈ ਤੁਹਾਨੂੰ ਕੀ ਚੱਲ ਰਿਹਾ ਅੰਦਰ ਤਕਲੀਫ ਅੱਛਾ ਜੀ ਓਕੇ ਸੋ ਮੈਨੂੰ ਲੱਗਦਾ ਤੁਸੀਂ ਮਤਲਬ ਤੁਹਾਡੇ ਨਾ ਅੰਦਰ ਉਹ ਹੋਣਗੇ ਅਲਸਰ ਹੋ ਹੋਣਗੇ ਇਸ ਲਈ ਤੁਹਾਡਾ ਐਬਡੋਮਨ ਪੇਨ ਹੋ ਰਿਹਾ ਔਰ ਵੋਮਿਟਿੰਗ ਆਈ ਵੀ ਆਈ ਆ ਅੱਖ ਵੀ ਕਲਰ ਅੱਛਾ ਤੁਸੀਂ ਇਹ ਮਤਲਬ ਫਿਲਹਾਲ ਤੁਸੀਂ ਮੇਰੀ ਪ੍ਰੋਕਿਊਸ਼ਨ ਲਈ ਇਹ ਫੋਲੋ ਕਰੋ ਕਿ ਤੁਸੀਂ ਇੱਕ ਮਤਲਬ ਜ਼ਿਆਦਾ ਨਮਕ ਮਿਲੀ ਨਾ ਜ਼ਿਆਦਾ ਮਿਰਚੀ ਵਾਲੀ ਕੋਈ ਚੀਜ਼ ਨਹੀਂ ਖਾਣੀ ਹੈਲਦੀ ਫੂਡ ਖਾਣਾ ਦਲੀਆ ਖਿਚੜੀ ਇੱਕ ਵਾਰੀ ਇਹ ਸਭ ਕੁਝ ਟਰਾਈ ਕਰੋ ਠੀਕ ਏ ਔਰ ਕੀ ਕਹਿੰਦੇ ਆ ਹਾਈ ਬਲੱਡ ਪ੍ਰੈਸ਼ਰ ਨਹੀਂ ਰੱਖਣਾ ਗਾ ਕਿਸੇ ਚੀਜ਼ 'ਤੇ ਵੀ ਗੁੱਸਾ ਨਹੀ ਕਰਨਾ ਗਾ ਓਕੇ ਔਰ ਆਪਣੀ ਜੋ ਰੈਗੂਲਰ ਮੈਡੀਸਨ ਕੋਈ ਮੈ ਮੈਡੀਕਲ ਤੋਂ ਮੈਡੀਸਨ ਲਿੱਤੀ ਆ ਕੋਈ ਓਕੇ ਕੇ ਇੱਕ ਤੁਸੀ ਰੋਜ਼ ਮੋਰਨਿੰਗ ਟਾਈਮ ਸੌਂਫ ਨੂੰ ਉਬਾਲ ਕੇ ਉਸ ਨੂੰ ਠੰਡਾ ਕਰਕੇ ਇੱਕ ਵਾਰੀ ਉਹ ਟਰਾਈ ਕਰਕੇ ਦੇਖੋ ਧਨੀਆ ਦਾ ਪੁਦੀਨੇ ਵਾਲਾ ਜੋ ਪਾਣੀ ਹੁੰਦਾ ਉਹ ਵੀ ਪੀ ਕੇ ਦੇਖੋ ਕਿਉਂਕਿ ਠੰਢੀ ਚੀਜ਼ ਪੀਓਗੇ ਤਾਂ ਤੁਹਾਡੇ ਅਲਸਰ ਡਾਈਟਿੰਗ ਉਹਦੇ ਨਾਲ ਰਲੀਫ ਮਿਲੇਗਾ ਕੋਈ ਹਾਂ ਬਟ ਮੈਡੀਸਨ ਵਟਸਅੱਪ ਮੈਡੀਸਨ ਕਰ ਦੂਗੀ ਮੈਡੀਸਨ ਵਟਸਅੱਪ ਕਰ ਦੂਗੀ ਓਕੇ ਤੋ ਬਾਕੀ ਤੁਸੀ ਇਹ ਮਤਲਬ ਮੈਡੀਸਨ ਲੈਣ ਤੋਂ ਬਾਅਦ ਅਗਰ ਤੁਹਾਨੂੰ ਥੋੜਾ ਰਲੀਫ ਮਿਲਣਾ ਸਟਾਰਟ ਹੋਇਆ ਤੋ ਦੈਨ ਓਕੇ ਤੁਸੀਂ ਇਹੀ ਮੈਡੀਸਨ ਲੈਂਦੇ ਰਹਿਓ ਅਗਰ ਨਹੀਂ ਵੀ ਮਤਲਬ ਤੁਹਾਨੂੰ ਹੋਇਆ ਤਾਂ ਤੁਸੀ ਮੈਨੂੰ ਆ ਕੇ ਚੈਕ ਅੱਪ ਕਰਵਾ ਕੇ ਜਾ ਸਕਦੇ ਹੋ ਔਰ ਔਰ

ਓਕੇ ਓਕੇ ਓਕੇ ਥੈਂਕ ਯੂ ਹਾਂਜੀ ਹਾਂਜੀ ਹਾਂਜੀ ਓਕੇ ਓਕੇ